ਭੰਗੜੇ ਦੇ ਕੁਛ ਆਮ ਸਟੈਪ ਇਸ ਦੌਰਾਨ ਪਹਿਲੇ ਪੈਰ ਚੁੱਕ ਕੇ ਅੱਗੇ ਪੈਰ ਕਰਕੇ ਅਤੇ ਬਾਹਵਾਂ ਉੱਪਰ ਚੁੱਕ ਕੇ ਭੰਗੜਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਦੂਜਾ ਸਟੈਪ ਉਹਦੇ ਵਿੱਚ ਬਾਹਵਾਂ ਉੱਪਰ ਚੱਕ ਕੇ ਅੱਡੀ ਚੱਕ ਕੇ ਨਾਲ ਅੱਗੇ ਪੈਰ ਕੀਤਾ ਜਾਂਦਾ ਹੈ ਇਹ ਕਿਉਂਕਿ ਇਹ ਸਾਡੇ ਸੱਭਿਆਚਾਰ 'ਤੇ ਦੇ ਬਾਰੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ ਕਿਉਂਕਿ ਇਸ ਨਾਲ ਅਸੀਂ ਆਪਦੇ ਪੰਜਾਬ ਨੂੰ ਆਪਦੇ ਸੱਭਿਆਚਾਰ ਨੂੰ ਜ਼ੋਰਾ ਸ਼ੋਰਾ ਨਾਲ ਪੇਸ਼ ਕਰ ਸਕਦੇ ਹਾਂ ਕਿਉਂਕਿ ਇਹੀ ਭਾਰਤ ਇਹ ਪੰਜਾਬ ਦੀ ਸ਼ਾਨ ਨੇ ਕਿਉਂਕਿ ਇਸ ਨਾਲ ਨੱਚ ਕੇ ਆਪਾਂ ਆਪਦੀ ਖੁਸ਼ੀ ਨੂੰ ਜ਼ਾਹਿਰ ਕਰ ਸਕਦੇ ਹਾਂ